ਗਿਆਰਾਂ ਫਰਵਰੀ ਉੱਨੀ ਸੋ ਪਚਾਨਵੇਂ ਅਠਾਰਾਂ ਫਰਵਰੀ ਦੋ ਹਜ਼ਾਰ ਵੀਹ ਵੀਹ ਦਸੰਬਰ ਉੱਨੀ ਸੋ ਬਾਨਵੇਂ ਚੌਦਾਂ ਦਿਸੰਬਰ ਉੱਨੀ ਸੋ ਬਾਨਵੇਂ ਦਸ ਜੂਨ ਉੱਨੀ ਸੋ ਪਚਾਨਵੇਂ